ਮੈਂ ਸਕੂਲ ਟਾਈਮ ਤੋਂ ਹੀ ਮੈਰਾਥੋਨ ਅਤੇ ਲੰਬੀਆਂ ਦੋੜਾਂ ਵਿੱਚ ਹਿੱਸਾ ਲੈਂਦਾ ਆਇਆ ਹਾਂ ਅਤੇ ਜਿੱਤਦਾ ਵੀ ਆ ਰਿਹਾ ਹਾਂ ਮੈਂ ਕੋਲਜ ਵਿੱਚ ਹਰੇਕ ਦੌੜ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਂਦਾ ਰਿਹਾ ਹਾਂ ਅਤੇ ਹਾਲ ਹੀ ਵਿੱਚ ਮੈਂ ਸਟੇਟ ਲੈਵਲ ਜਿੱਤ ਕੇ ਆਇਆ ਹਾਂ ਇ ਵੈਸੇ ਤਾਂ ਮੈਂ ਬਚਪਨ ਤੋਂ ਹੀ ਦੌੜਾਂ ਵਿੱਚ ਹਿੱਸਾ ਲੈਂਦਾ ਆਇਆ ਹਾਂ ਪਰ ਨੈਸ਼ਨਲ ਲੈਵਲ ਦੀ ਤਿਆਰੀ ਮੈਂ ਚੰਡੀਗੜ੍ਹ ਜਾ ਕੇ ਕੀਤੀ ਚੰਡੀਗੜ੍ਹ ਵਿੱਚ ਮੈਂ ਖਾਲਸਾ ਅਕੈਡਮੀ ਵਿੱਚ ਦਾਖਲਾ ਲਿਆ ਉੱਥੇ ਮੈਨੂੰ ਸਵੇਰੇ ਚਾਰ ਵਜੇ ਹੀ ਉਠਾ ਦਿੰਦੇ ਸਨ ਅਤੇ ਮੈਂ ਵੀ ਉੱਥੇ ਮਨ ਲਗਾ ਕੇ ਮਿਹਨਤ ਕੀਤੀ ਸਵੇਰੇ ਚਾਰ ਵਜੇ ਉੱਠ ਕੇ ਪਹਿਲਾਂ ਤਾਂ ਗਰਾਊਂਡ ਦੇ ਪੰਜ ਚੱਕਰ ਲਗਾਉਂਦੇ ਸੀ ਤੇ ਬਾਅਦ ਵਿੱਚ ਸਾਨੂੰ ਐਕਸ ਸਰ ਐਕਸਰਸਾਈਜ਼ ਕਰਾਉਂਦੇ ਸੀ ਚਾਰ ਵਜੇ ਤੋਂ ਨੌ ਵਜੇ ਤੱਕ ਅਸੀਂ ਉੱਥੇ ਮਨ ਲਗਾ ਕੇ ਮਿਹਨਤ ਕਰਦੇ ਸਨ ਉਸ ਦੌਰਾਨ ਮੈਂ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਬਾਹਰਲੀਆਂ ਅਤੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖਿਆ